ਬਾਰ੍ਹਾਂ ਸਤੰਬਰ ਦੋ ਹਜ਼ਾਰ ਦੋ ਚੌਦ੍ਹਾਂ ਫਰਵਰੀ ਦੋ ਹਜ਼ਾਰ ਚਾਰ ਇੱਕ ਨਵੰਬਰ ਉੱਨੀ ਸੌ ਅਠਤਾਲੀ ਚੌਦ੍ਹਾਂ ਫਰਵਰੀ ਉੱਨੀ ਚਾਰ ਜਨਵਰੀ ਦੋ ਹਜ਼ਾਰ ਚਾਰ